ਮੈਂ ਹਰਜੀਤ ਕੌਰ ਆ ਗੁਰਦਾਸਪੁਰ ਤੋਂ ਬੋਲਦੀ ਪਈ ਹਾਂ ਜੀ ਸਤਿ ਸ਼੍ਰੀ ਅਕਾਲ ਵੱਖ ਵੱਖ ਕਿਸਮਾਂ ਦੇ ਜਾਨਵਰ ਗਾਵਾਂ ਮੱਝਾਂ ਬੱਕਰੀਆਂ ਅਸੀਂ ਮਤਲਬ ਕਿ ਘਰ ਵਿੱਚ ਇਨ੍ਹਾਂ ਨੂੰ ਰੱਖਿਆ ਹੋਇਆ ਇਨ੍ਹਾਂ ਦਾ ਕੰਮ ਕੰਮ ਕਰਦੇ ਹਾਂ ਪਸ਼ੂ ਪਾਲਣ ਦਾ ਕੰਮ ਕਰਦੇ ਹਾਂ ਸਾਨੂੰ ਗਾਵਾਂ ਮੱਝਾਂ ਤੋਂ ਦੁੱਧ ਪ੍ਰਾਪਤ ਹੁੰਦਾ ਵਾ ਉਹ ਫਿਰ ਦੁੱਧ ਅਸੀਂ ਡੇਰੀਆਂ ਦੇ ਵਿੱਚ ਪਾਉਂਦੇ ਹਾਂ ਡੇਰੀਆਂ ਵਿੱਚ ਦੁੱਧ ਪਾ ਕੇ ਸਾਨੂੰ ਜਿਹੜੀ ਵੀ ਆਮਦਨ ਹੁੰਦੀ ਆ ਉਹਦੇ ਨਾਲ ਅਸੀਂ ਆਪਣੇ ਸਾਰਾ ਘਰ ਦਾ ਵੀ ਗੁਜ਼ਾਰਾ ਕਰਦੇ ਹਾਂ ਅਤੇ ਜਿਹੜੀਆਂ ਭੇਡਾਂ ਭੇਡਾਂ ਗਊਆਂ ਗਊਆਂ ਸਾਨੂੰ ਦੁੱਧ ਦਿੰਦੀਆਂ ਜੋ ਕਿ ਬੱਚਿਆਂ ਦੇ ਪੀਣ ਵਿੱਚ ਕਾਫ਼ੀ ਕੰਮ ਮਤਲਬ ਕਿ ਬੱਚੇ ਗਊਆਂ ਦਾ ਦੁੱਧ ਹੀ ਜ਼ਿਆਦਾ ਦਿੱਤਾ ਜਾਂਦਾ ਵਾ ਭੇਡਾਂ ਤੋਂ ਸਾਨੂੰ ਉੱਨਾਂ ਪ੍ਰਾਪਤ ਹੁੰਦੀਆਂ ਵਾਂ ਜਿਹੜੀਆਂ ਬੱਕਰੀਆਂ ਹੈਗੀਆਂ ਵਾਂ ਅੱਜ ਕੱਲ੍ਹ ਲੋਕਾਂ ਨੂੰ ਡੇਂਗੂ ਦਾ ਬਹੁਤ ਹੀ ਜ਼ਿਆਦਾ ਮਤਲਬ ਵੀ ਬਿਮਾਰੀਆਂ ਚੱਲੀਆਂ ਵਾਂ ਅਤੇ ਬੱਕਰੀ ਦਾ ਦੁੱਧ ਜਿਹੜਾ ਹੈਗਾ ਵਾ ਉਨ੍ਹਾਂ ਵਾਸਤੇ ਵੀ ਬਹੁਤ ਕੰਮ ਆਉਂਦਾ ਵਾ ਜਿਹੜੀਆਂ ਮੁਰਗੀਆਂ ਵਾ ਉਨ੍ਹਾਂ ਵਿੱਚ ਅਸੀਂ ਜਿੱਦਾਂ ਆਂਡੇ ਆਂਡੇ ਵੀ ਅਸੀਂ ਮਤਲਬ ਕਿ ਲੈ ਕੇ ਉਨ੍ਹਾਂ ਕੰਮ ਕਰਦੇ ਹਾਂ ਆਂਡੇ ਵੀ ਵੇਚਦੇ ਹਾਂ ਅਤੇ ਜਿਹੜੇ ਵੀ ਜਿਹੜੇ ਜਾਨਵਰ ਓਹੀ ਇੱਕ ਮਤਲਬ ਕਿ ਪਹਿਲਾਂ ਅਸੀਂ ਘਰ ਦੇ ਵਿੱਚ ਰੱਖੇ ਹੋਏ ਸੀ ਹੁਣ ਅਸੀਂ ਜਿਹੜੇ ਜਾਨਵਰ ਇੱਕ ਜਗ੍ਹਾ ਲੈ ਕੇ ਉਹਦੇ ਵਿੱਚ ਪਾਲਦੇ ਪਏ ਹਾਂ ਉਨ੍ਹਾਂ ਦੇ ਵਿੱਚ ਜਾਨਵਰ ਰੱਖੇ ਹੋਏ ਆ ਇੱਕੱਠੇ ਹੀ ਸਾਰੇ ਅਸੀਂ ਆਪਣਾ ਜਿਹੜਾ ਕਾਰੋਬਾਰ ਆ ਇਨ੍ਹਾਂ ਜਾਨਵਰਾਂ ਤੋਂ ਹੀ ਮਤਲਬ ਕਿ ਚਲਾਉਂਦੇ ਪਏ ਹਾਂ ਅਤੇ ਜਿਹੜੇ ਜਾਨਵਰ ਹੈਗੇ ਆ ਉਨ੍ਹਾਂ ਨੂੰ ਇੱਕ ਮਤਲਬ ਕਿ ਖਾਲੀ ਜਿਹੀ ਜਗ੍ਹਾ ਲੈ ਕੇ ਅਸੀਂ ਉਹਦੇ ਦੇ ਵਿੱਚ ਉਨ੍ਹਾਂ ਨੂੰ ਰੱਖਿਆ ਵਾ ਸਾਰਿਆਂ ਨੂੰ ਅਤੇ ਜਿਹੜੀਆਂ ਅਸੀਂ ਪਸ਼ੂ ਪਸ਼ੂ ਜਿਹੜੇ ਪਾਲਦੇ ਹਾਂ ਜਿਹੜੀਆਂ ਉਨ੍ਹਾਂ ਦੀਆਂ ਰਣਨੀਤੀਆਂ ਏ ਨੀਤੀਆਂ ਵਾਂ ਉਹ ਅਸੀਂ ਇੱਕ ਹੀ ਕੰਮ ਹੀ ਇਹੋ ਰਨ ਇਹੋ ਹੀ ਕਰਦੇ ਹਾਂ ਸਾਡਾ ਗੁਜ਼ਾਰਾ ਹੀ ਪਸ਼ੂ ਜਿਵੇਂ ਮ ਮੱਝਾਂ ਦਾ ਦੁੱਧ ਵੇਚਣਾ ਗਾਵਾਂ ਦਾ ਦੁੱਧ ਨੂੰ ਵੇਚਣਾ ਉਨ੍ਹਾਂ ਨੂੰ ਡੇਰੀ ਦੇ ਵਿੱਚ ਪਾਉਣਾ ਅੱਗੇ ਤਾਂ ਅਸੀਂ ਥੋੜ੍ਹਾ ਮਤਲਬ ਕੀ ਕਰਦੇ ਸੀ ਆਪਣੇ ਆਪ ਜੋਗਾ ਕੰਮ ਕਰਦੇ ਸੀ ਹੁਣ ਸਾਨੂੰ ਆਮਦਨ ਹੋਣ ਕਰਕੇ ਅਸੀਂ ਹੋਰ ਵੀ ਜਗ੍ਹਾ ਲੈ ਕੇ ਹੋਰ ਵੀ ਥੋੜ੍ਹੇ ਮਤਲਬ ਕਿ ਰੱਖ ਕੇ ਕੰਮ ਕਾਰ ਵਾਲੇ ਲੋਕ ਉਹ ਸਾਡਾ ਕੰਮ ਉਨ੍ਹਾਂ ਦੇ ਨਾਲ ਅਸੀਂ ਉਨ੍ਹਾਂ ਦਾ ਉਹ ਵੀ ਸਾਡੇ ਨਾਲ ਕੰਮ ਕਰਦੇ ਨੇ ਅਤੇ ਅਸੀਂ ਇੱਕ ਆਪਣੀ ਆਮਦਨ ਦਾ ਜਿਹੜਾ ਹੈਗਾ ਵਾ ਉਹ ਅਸੀਂ ਆਪਣਾ ਸਰੋਤ ਬਣਾਇਆ ਕੰਮ ਕਾਰੋਬਾਰ ਸ਼ੁਰੂ ਕੀਤਾ ਵਾ ਅਤੇ ਅਸੀਂ ਇਹਦੇ ਵਿੱਚ ਸਾਰਾ ਹੀ ਗੁਜ਼ਾਰਾ ਕਰਦੇ ਹਾਂ